ਰੂਪਨਗਰ ਜ਼ਿਲ੍ਹੇ ਵਿੱਚ ਮੌਸਮ ਬਹੁਤ ਹੀ ਸੁਹਾਵਣਾ ਹੈ ਗਰਮੀਆਂ ਦੇ ਵਿੱਚ ਕਾਫੀ ਗਰਮੀ ਪੈਂਦੀ ਹੈ ਅਤੇ ਸਰਦੀਆਂ ਦੇ ਵਿੱਚ ਕਾਫੀ ਠੰਡ ਪੈਂਦੀ ਹੈ ਬਰਸਾਤ ਦੀ ਰੁੱਤ ਵਿੱਚ ਮੀਂਹ ਦੀ ਜ਼ੋਰ ਕਾਫੀ ਰਹਿੰਦਾ ਹੈ ਕਈ ਵਾਰ ਤਾਂ ਨਾਲ ਦੇ ਘਰ ਵੀ ਛੱਡ ਜਾਂਦਾ ਮੀਂਹ ਅਤੇ ਇਸ ਤਰ੍ਹਾਂ ਦੇ ਨਾਲ ਬੜਾ ਸੁਹਾਵਣਾ ਜਾ ਮੌਸਮ ਬਣਦਾ ਹੈ ਇਹਦੇ ਵਿੱਚ ਹੁਣੇ ਹੁਣੇ ਬਦਲਾਅ ਹੋਇਆ ਹੈ ਜੋ ਪੰਦਰਾਂ ਜੂਨ ਤੋਂ ਪੰਦਰਾਂ ਸਤੰਬਰ ਤੱਕ ਬਰਸਾਤ ਦਾ ਮੌਸਮ ਸੀਗਾ ਉਹ ਇਉਂ ਜਾਪਦਾ ਕਿ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ ਗਰਮੀ ਦੇ ਮਹਿਸੂਸ ਨਹੀਂ ਹੋਈ ਇੰਨੀ ਪਰ ਹੁਣ ਕੁਝ ਇਸ ਤਰ੍ਹਾਂ ਲੱਗਿਆ ਕਿ ਟੈਂਪਰੇਚਰ ਜਿਹੜਾ ਹੈਗਾ ਤਾਪਮਾਨ ਹੈ ਕੁਝ ਵੱਧ ਰਿਹਾ ਪਰ ਸ਼ਾਮ ਵੇਲੇ ਫਿਰ ਠੰਡ ਹੋ ਜਾਂਦੀ ਹੈ ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਹੈ ਮੌਸਮ ਬਹੁਤ ਸੁਹਾਵਣਾ ਹੈ